ਸਾਡੇ ਪਿੰਡ ਵਿੱਚ ਇੱਕ ਸੈਣੀ ਢਾਬਾ ਹੈ ਉੱਥੇ ਬਹੁਤ ਹੀ ਵਧੀਆ ਖਾਣਾ ਮਿਲਦਾ ਹੈ ਮੈਂ ਉੱਥੇ ਇੱਕ ਦਿਨ ਆਪਣੇ ਫਰੈਂਡਸ ਨਾਲ਼ ਖਾਣਾ ਖਾਣ ਗਈ ਉੱਥੇ ਮੈਂ ਖਾਣਾ ਤਾਂ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਖਾਣੀ ਸੀ ਪਰ ਉੱਥੇ ਤਾਂ ਉੱਥੇ ਜਾ ਕੇ ਪਤਾ ਲੱਗਿਆ ਕਿ ਉੱਥੇ ਨਿਊਡਲ ਅਤੇ ਟਿੱਕੀਆਂ ਅਤੇ ਕਈ ਤਰ੍ਹਾਂ ਦੇ ਪਕਵਾਨ ਮਿਲਦੇ ਹਨ ਫਿਰ ਮੈਂ ਉੱਥੇ ਉੱਥੇ ਸਾਨੂੰ ਸਰ੍ਹੋਂ ਦੇ ਸਾਗ ਅਤੇ ਮੱਕੀ ਦੀ ਰੋਟੀ ਤਾਂ ਨਹੀਂ ਖਾਧੀ ਪਰ ਸਾਨੂੰ ਨਿਊਡਲ ਅਤੇ ਟਿੱਕੀਆਂ ਹੀ ਖਾਧੀਆਂ ਖਾਧੀਆਂ ਉਹ ਖਾ ਕੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਵਧੀਆ ਲੱਗਿਆ ਫਿਰ ਉੱਥੇ ਸ ਪਤਾ ਲੱਗਿਆ ਕਿ ਉੱਥੇ ਤਾਂ ਗੋਰੇ ਵੀ ਆਉਂਦੇ ਹਨ ਉੱਥੋਂ ਦਾ ਖਾਣਾ ਤਾਂ ਬਹੁਤ ਹੀ ਸਵਾਦ ਹੁੰਦਾ ਹੈ ਸਵਾਦ ਹੁੰਦਾ ਹੈ ਉੱਥੋਂ ਦਾ ਸਾਰੇ ਹੀ ਲੋਕ ਉੱਥੇ ਹੀ ਖਾਂਦੇ ਹਨ ਬਹੁਤ ਹੀ ਸੈਣੀ ਢਾਬੇ ਦੀ ਬਹੁਤ ਹੀ ਤਾਰੀਫ਼ ਕਰਦੇ ਹਨ ਕਿ ਉੱਥੇ ਦਾ ਰੇਟ ਵੀ ਬਹੁਤ ਹੀ ਘੱਟ ਹੁੰਦਾ ਹੈ ਕਈ ਵਾਰ ਤਾਂ ਮੈਂ ਸੋਚਦੀ ਹਾਂ ਕਿ ਇਹਨਾਂ ਦੀ ਕਿੰਨੀ ਕੁ ਕਮਾਈ ਹੁੰਦੀ ਹੋਵੇਗੀ ਦਿਨ ਦੀ ਉਹਨਾਂ ਦਾ ਕਿਰਾਏ ਉਹ ਤਾਂ ਪੈਸੇ ਵੀ ਠੀਕ ਠੀਕ ਲੈਂਦੇ ਸੀ ਫਿਰ ਵੀ ਉਹਨਾਂ ਦਾ ਖਾਣਾ ਬਹੁਤ ਹੀ ਸਵਾਦ ਹੁੰਦਾ ਸੀ ਅਤੇ ਅਸੀਂ ਉੱਥੋਂ ਦੀਆਂ ਸੈਲਫੀਆਂ ਵੀ ਲਈਆਂ ਅਤੇ ਫਿਰ ਅਸੀਂ ਸੈਲਫੀਆਂ ਖਿੱਚ ਕੇ ਇੰਟਰਨੈੱਟ 'ਤੇ ਵੀ ਪਾਈਆਂ ਧੰਨਵਾਦ